ਹੈਲੋ ਸਤਿ ਸ਼੍ਰੀ ਅਕਾਲ

ਹਾਂਜੀ ਨਹੀਂ ਹਾਲੇ ਤਾਂ ਨਹੀਂ ਹਾਲੇ ਤਾਂ ਨਹੀਂ ਸੀਤਾ ਹੈਗਾ ਓਕੇ ਕਦੋਂ ਚਾਹੀਦਾ ਆਪਾਂ ਨੂੰ ਫਿਰ ਵੀ ਇਤਨੀ ਜਲਦੀ ਹੋ ਤਾਂ ਨਹੀਂ ਸਕਦਾ ਚੱਲੋ ਮੈਂ ਵਰਕਰ ਨੂੰ ਆਪਣੇ ਨੂੰ ਪੁੱਛਦਾ ਹੈ ਵੀ ਕੀ ਇੰਨੀ ਜਲਦੀ ਹੋ ਸਕਦਾ ਹੈ ਫਿਰ ਤੁਸੀਂ ਆ ਕੇ ਵਿਜੀਟ ਕਰ ਜਾਇਓ ਇੱਕ ਵਾਰੀ ਸਟੋਰ 'ਤੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਅਸੀਂ ਕੋਸ਼ਿਸ਼ ਕਰਾਂਗੇ ਓਕੇ ਓਕੇ ਥੈਂਕ ਯੂ